ਹੈਲੋ ਹਾਂਜੀ ਮੈਂ ਦਸ ਦਿਨ ਪਹਿਲਾਂ ਇੱਕ ਫਲਿਪਕਾਟ ਤੋਂ ਇੱਕ ਪ੍ਰਫਿਊਮ ਮੰਗਵਾਇਆ ਸੀ ਜਦੋਂ ਸਰ ਉਹਦੀ ਡਿਲੀਵਰੀ ਮੇਰੇ ਘਰ ਪੁੱਜੀ ਤਾਂ ਇੱਕ ਤਾਂ ਤੁਸੀਂ ਜਿਹੜੀ ਡਿਲੀਵਰੀ ਬਹੁਤ ਲੇਟ ਪਹੁੰਚਾਈ ਜੀ ਅਤੇ ਜਿਹੜੀ ਪੈਕੇਜਿੰਗ ਸੀ ਉਹ ਵੀ ਕਾਫੀ ਡੈਮੇਜ ਹੋ ਚੁੱਕੀ ਸੀ ਉਸ ਚੀਜ਼ ਨੂੰ ਦੇਖ ਕੇ ਮੈਂ ਕੁਝ ਬੜਾ ਹੈਰਾਨ ਜਿਹਾ ਹੋਇਆ ਅਤੇ ਜਦੋਂ ਪੈਕਿੰਗ ਖੋਲ੍ਹੀ ਹੈ ਤਾਂ ਉਸ ਦੌਰਾਨ ਵੀ ਕੁਛ ਉਹ ਚਿੱਬ ਚੱਬ ਜਿਹੇ ਉਹਦੇ ਵਿੱਚ ਪਏ ਸੀ ਚਲੋ ਉਹ ਤਾਂ ਮੰਨ ਲਏ ਚਲੋ ਉਹ ਚੱਲ ਗਿਆ ਉਸ ਤੋਂ ਬਾਅਦ ਜਦੋਂ ਮੈਂ ਉਸਦਾ ਪ੍ਰਫਿਊਮ ਦਾ ਜਦੋਂ ਢੱਕਣ ਖੋਲ੍ਹਿਆ ਜਦ ਪ੍ਰਫਿਊਮ ਬੋਡੀ 'ਤੇ ਸਪਰੇਅ ਕੀਤਾ ਤਾਂ ਉਹਦੀ ਜਿਹੜੀ ਫਰੈਗਨੈਂਸ ਜਾਂ ਮਹਿਕ ਬੜੀ ਹੀ ਗੰਦੀ ਸੀਗੀ ਅਤੇ ਉਹਦੇ ਕਰਕੇ ਮੇਰਾ ਹੈਡ ਪੇਨ ਸਿਰ ਪੇਨ ਕਾਫੀ ਹੋ ਰਿਹਾ ਸੀ ਅਤੇ ਇਹੀ ਮੈਂ ਐਕਸਪੀਰੀਅੰਸ ਆਪਣੇ ਘਰਦਿਆਂ ਨੂੰ ਜਦੋਂ ਦੱਸਿਆ ਤਾਂ ਉਹਨਾਂ ਨੇ ਮੇਰੇ ਨਾਲ ਇਸ ਚੀਜ਼ 'ਤੇ ਬੜੇ ਨਾਰਾਜ਼ ਹੋਏ ਸੋ ਮੈਂ ਚਾਹੁੰਦਾ ਹਾਂ ਜਿਹੜਾ ਇਹ ਪ੍ਰਫਿਊਮ ਤੁਸੀਂ ਮੈਨੂੰ ਭੇਜਿਆ ਇੱਕ ਤਾਂ ਇਹ ਬਿਲਕੁਲ ਹੀ ਦੇਸੀ ਜਿਹੀ ਕੰਪਨੀ ਜਿਹੀ ਦਾ ਹੈ ਕੋਈ ਇਹ 'ਤੇ ਮਾਰਕ ਆ ਜਾਂ ਲੈਵਲ ਵੀ ਕੋਈ ਅੱਛਾ ਨਹੀਂ ਹੈਗਾ ਜੋ ਦਿਖਾਇਆ ਸੀ ਉਹ ਨਹੀਂ ਹੈ ਮੈਂ ਚਾਹੁੰਦਾ ਕਿ ਜ ਆਪਣਾ ਇਹ ਵਾਪਸ ਕੀਤਾ ਜਾਵੇ